ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਅਤੇ ਇਹਨਾਂ ਨਾਲ ਸੈੱਲ ਵੀ ਘੱਟ ਸਕਦੇ ਹਨ ਇਹਨਾਂ ਤੋਂ ਬਚਣ ਲਈ ਸਾਨੂੰ ਆਸ ਪਾਸ ਦੀ ਸਫਾਈ ਰੱਖਣੀ ਚਾਹੀਦੀ ਹੈ ਘਰ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਗਲੀ ਵਿੱਚ ਸਾਨੂੰ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ ਮੀਂਹ ਵਿੱਚ ਅਤੇ ਕਚਰਾ ਨਹੀਂ ਫਿਲ ਫੈਲਾਉਣਾ ਚਾਹੀਦਾ ਇਹਨਾ ਕਰਕੇ ਮੱਛਰ ਆ ਬਹੁਤ ਜ਼ਿਆਦਾ ਹੋ ਸਕਦੇ ਹਨ ਅਤੇ ਆਪਣੇ ਬੱਚਿਆਂ ਨੂੰ ਓਡੋਮੋਸ ਲਗਾ ਕੇ ਬਾਹਰ ਖੇਡਣ ਲਈ ਭੇਜਣਾ ਚਾਹੀਦਾ ਹੈ ਤੁਸੀਂ ਘਰ ਵਿੱਚ ਮੱਛਰਾਂ ਤੋਂ ਬਚਣ ਲਈ ਯੰਤਰ ਵੀ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਸਪਰੇਅ ਹਿੱਟ ਵਗੈਰਾ ਇਹਨਾਂ ਤੋਂ ਤੁਸੀਂ ਮੱਛਰ ਤੋਂ ਬਚ ਸਕਦੇ ਹੋ ਅਤੇ ਇਹਨਾਂ ਤੋਂ ਬਚਣ ਲਈ ਸਾਨੂੰ ਕੂੜਾ ਨਹੀਂ ਫੈਲਾਉਣਾ ਚਾਹੀਦਾ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖਰੇ ਡਸਟਬਿਨ ਵਿੱਚ ਪਾਉਣਾ ਚਾਹੀਦਾ ਹੈ ਅਤੇ ਉਹ ਕੂੜੇ ਵਾਲੀ ਗੱਡੀ ਨੂੰ ਵਿੱਚ ਸੁੱਟ ਦੇਣਾ ਚਾਹੀਦਾ ਹੈ